ਜਿਵੇਂ ਕਿ ਪੁੱਛਿਆ ਗਿਆ ਹੈ ਕਿ ਪੰਜਾਬ ਵਿੱਚ ਵੱਡੇ ਕਾਰੋਬਾਰੀ ਮੌਕੇ ਜਾਂ ਸੰਭਾਵਨਾਵਾਂ ਕੀ ਹਨ ਇਹਨਾਂ ਵਿੱਚੋਂ ਕੁਛ ਮਹੱਤਵਪੂਰਨ ਇਹ ਹੈ ਪਹਿਲਾ ਹੈ ਕਰਸੀ ਅਤੇ ਖੇਤੀਬਾੜੀ ਪੰਜਾਬ ਨੂੰ ਭਾਰਤ ਦਾ ਅੰਨ ਦੇ ਦਾਨ ਨਾਨ ਕਿਹਾ ਜਾਂਦਾ ਹੈ ਇੱਥੇ ਦੇ ਖੇਤੀਬਾੜੀ ਖੇਤਰ ਵਿੱਚ ਬਹੁਤ ਸਾਰੇ ਕਾਰੋਬਾਰੀ ਮੌਕੇ ਹਨ ਫਸਲਾਂ ਜਿਵੇਂ ਕਿ ਗੇਹੂੰ ਚਾਵਲ ਮੱਕੀ ਗੰਨਾ ਆਦਿ ਦੀ ਉਪਜ ਵਿੱਚ ਇਹਨਾਂ ਦੇ ਮੁੱਖ ਪੱਧਰਾਂ ਵਿੱਚੋਂ ਇੱਕ ਹੈ ਖੇਤੀਬਾੜੀ ਵਿੱਚ ਨਵੀਂ ਤਕਨੀਕਾਂ ਦੀ ਵਰਤੋਂ ਕਰਕੇ ਉਤਪਾਦਨ ਵਧਾਉਣ ਅਤੇ ਨਵੇਂ ਉਤਪਾਦਨ ਮੋਡਲਾਂ ਦਾ ਅਨੁਸਰਨ ਕਰਕੇ ਕਿਸਾਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹਨ ਦੂਜਾ ਹੈ ਦੁੱਧ ਉਤਪਾਦਨ ਪੰਜਾਬ ਦੁੱ ਦੁੱਧ ਉਤਪਾਦਨ ਵਿੱਚ ਵੀ ਅੱਗੇ ਵੜ ਹੈ ਦੁੱਧ ਦੇ ਵਿਆਏ ਵਿੱਚ ਸ਼ੁਰੂਆਤ ਕਰਨ ਲਈ ਬਹੁਤ ਸਾਰੇ ਮੌਕੇ ਹਨ ਦੁੱਧ ਤੋਂ ਬਣੇ ਉਤਪਾਦ ਜਿਵੇਂ ਕਿ ਪਨੀਰ ਘਿਓ ਦਹੀਂ ਆਦਿ ਦੀ ਮੰਗ ਹਮੇਸ਼ਾ ਵੜਦੀ ਰਹਿੰਦੀ ਹੈ ਇਸ ਖੇਤਰ ਵਿੱਚ ਨਵੀਂ ਤਕਨੀਕਾਂ ਅਤੇ ਸਬਸਿਡੀ ਨਾਲ ਕਮਾਈ ਦੇ ਬਹੁਤ ਸਾਰੇ ਰਾਹ ਪਾਸੇ ਹਨ ਪਨੀਰ ਜੋ ਕਿ ਆਪਣੇ ਸਰੀਰ ਨੂੰ ਤਾਕਤ ਪ੍ਰਦਾਨ ਦਿੰ ਕਰ ਦਿੰਦਾ ਹੈ ਤਾਂ ਕਰਕੇ ਦੁੱਧ ਉਤਪਾਦਨ ਦਾ ਬਿਜ਼ਨਸ ਵੀ ਬਹੁਤ ਵਧੀਆ ਚੱਲ ਸਕਦਾ ਹੈ ਦਹੀਂ ਦਹੀਂ ਖਾਣ ਨਾਲ ਆਪਾਂ ਨੂੰ ਬਹੁਤ ਸਾਰੇ ਵਿਟਾਮਿਨਸ ਮਿਲਦੇ ਹਨ ਤਾਂ ਕਰਕੇ ਦੁੱਧ ਉਤਪਾਦਨ ਦਾ ਬਿਜ਼ਨਸ ਆਪਾਂ ਨੂੰ ਕਰਨਾ ਚਾਹੀਦਾ ਹੈ ਤੀਜਾ ਹੈ ਹੱਥ ਕਲਾਕਾਰੀ ਅਤੇ ਹੱਥ ਕਾਰੀਗਿਰੀ ਪੰਜਾਬ ਦੀ ਹੱਥ ਕਾਲਾਕਾਰੀ ਅਤੇ ਹੱਥ ਕਾਰੀਗਿਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਫੁਲਕਾਰੀ ਜੁੱਤੀ ਲੱਕੜ ਦੇ ਕੰਮ ਫਰਨੀਚਰ ਸੂਚਕਾਰੀ ਆਦਿ ਦੀ ਮੰਗ ਦੇਸ਼ ਅਤੇ ਵਿਦੇਸ਼ ਦੋਹਾਂ ਵਿੱਚ ਬਹੁਤ ਹੈ ਇਹ ਕਾਰੋਬਾਰ ਘਰੇਲੂ ਮਹਿਲਾਵਾਂ ਅਤੇ ਛੋਟੇ ਹੱਥ ਕਲਾਕਾਰ ਲਈ ਵੱਡਾ ਮੌਕਾ ਪ੍ਰਦਾਨ ਕਰਦੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮੇਲੇ ਲੱਗਦੇ ਹਨ ਜਿਵੇਂ ਸਰਸ ਮੇਲਾ ਹੋਰ ਬਹੁਤ ਭਿੰਨਤਾ ਦੇ ਮੇਲੇ ਲੱਗਦੇ ਹਨ ਇੱਥੇ ਆਪਾਂ ਨੂੰ ਬਹੁਤ ਸਾਰੇ ਹੱਥ ਕਲਾਕਾਰੀ ਨਾਲ ਬਣੀਆਂ ਹੋਈਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜੋ ਕਿ ਲੋਕਾਂ ਨੂੰ ਵੀ ਬਹੁਤ ਪਸੰਦ ਆਉਂਦੀਆਂ ਹਨ ਅਤੇ ਉਹਨਾਂ ਦਾ ਧਿਆਨ ਵੀ ਇਸੇ ਵੱਲ ਜਾਂਦਾ ਹੈ ਕਿ ਉਹ ਜ਼ਿਆਦਾਤਰ ਹੈਂਡਮੇਡ ਚੀਜ਼ਾਂ ਨੂੰ ਹੀ ਲੈਣ ਚੌਥਾ ਹੈ ਭੋਜਨ ਪ੍ਰਸ਼ੰਸ਼ਕ ਪ੍ਰਸ਼ੰਸਕਰਨ ਪੰਜਾਬ ਦੇ ਭੋਜਨ ਪ੍ਰਸ਼ੰਸਕਰਨ ਉਦਯੋਗ ਵਿੱਚ ਬਹੁਤ ਵੱਡੇ ਮੌਕੇ ਹਨ ਸੁੱਕਾ ਦੁੱਧ ਬਿਸਕਿਟ ਪੈਕਟ ਸਨੈਕਸ ਜੂਸ ਅਤੇ ਹੋਰ ਸਾਰੇ ਬਹੁਤ ਸਾਰੇ ਭੋਜਨ ਪ੍ਰਸ਼ੰਸਕਰਨ ਉਤਪਾਦਾਂ ਦੀ ਮੰਗ ਹਮੇਸ਼ਾ ਰਹਿੰਦੀ ਹੈ ਇਸ ਖੇਤਰ ਵਿੱਚ ਨਵੇਂ ਯਤਨ ਅਤੇ ਉੱਦਮ ਕਰਨ ਵਾਲੇ ਲੋਕਾਂ ਲਈ ਬਹੁਤ ਸਾਰੇ ਮੌਕੇ ਹਨ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਪੰਜਾਬ ਵਿੱਚ ਲੋਕ ਖਾਣ ਪਾਨ ਨੂੰ ਹੀ ਜ਼ਿਆਦਾ ਬੜੋਤਰੀ ਦਿੰਦੇ ਹਨ ਉਹਨਾਂ ਦਾ ਧਿਆਨ ਖਾਣ ਪੀਣ ਵਿੱਚ ਹੀ ਹੁੰਦਾ ਹੈ ਤਾਂ ਖਾਣ ਪੀਣ ਦਾ ਕੰਮ ਵੀ ਕੀਤਾ ਜਾਵੇ ਤਾਂ ਇਸ ਵਿੱਚ ਵੀ ਬਹੁਤ ਸਾਰੀ ਕਮਾਈ ਹੋ ਸਕਦੀ ਹੈ ਪੰਜਵਾਂ ਹੈ ਅੰਤਰਰਾਸ਼ਟਰੀ ਵਪਾਰ ਪੰਜਾਬ ਵਿੱਚ ਫਲ ਅਤੇ ਸਬਜ਼ੀਆਂ ਦੇ ਨਿਰਯਾਤ ਦੇ ਵੱਡੇ ਮੌਕੇ ਹਨ ਅੰਬ ਕਿਨੂੰ ਅੰਗੂਰ ਅਤੇ ਹੋਰ ਮੌਸਮੀ ਫਲਾਂ ਦੇ ਨਿਰਯਾਤ ਕਰਕੇ ਬਹੁਤ ਵਧੀਆ ਕਮਾਈ ਕਰ ਸਕਦੇ ਹਨ ਸਾਥ ਹੀ ਸਬਜ਼ੀਆਂ ਜਿਵੇਂ ਕਿ ਟਮਾਟਰ ਪਿਆਜ਼ ਆਲੂ ਆਦਿ ਦੀ ਨਿਰਯਾਤ ਵੀ ਵੱਡੇ ਵਿੱਚ ਵੀ ਵੱਡੇ ਮੌਕੇ ਹਨ ਛੇਵਾਂ ਹੈ ਸਰਵਿਸ ਸੈਕਟਰ ਯਾਤਰਾ ਏਜੰਸੀ ਟੂਰ ਗਾਇਡ ਹੋਟਲ ਰੈਸਟੋਰੈਂਟ ਦੋਬ ਵਿੱਚ ਵੀ ਬਹੁਤ ਵੱਡੇ ਮੌਕੇ ਹਨ ਪੰਜਾਬ ਦੇ ਵੱਖ ਵੱਖ ਸੈਲਾਨੀ ਸਥਾਨਾਂ ਨੂੰ ਵੇਖਣ ਆਉਣ ਵਾਲੇ ਸੈਲਾਨੀਆਂ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਰੋਬਾਰੀਆਂ ਦੇ ਲਈ ਵੱਡੀ ਮੌਕੇ ਹਨ ਨਤੀਜਾ ਇਹ ਹੈ ਕਿ ਪੰਜਾਬ ਵਿੱਚ ਵਿਆਪਕ ਕਾਰੋਬਾਰੀ ਮੌਕੇ ਹਨ ਖੇਤੀਬਾੜੀ ਤੋਂ ਲੈ ਕੇ ਉਤਪਾਦਨ ਤੱਕ ਸੇਵਾਵਾਂ ਤੋਂ ਲੈ ਕੇ ਨਿਰਯਾਤ ਤੱਕ ਹਰ ਖੇਤਰ ਵਿੱਚ ਉੱਦਮ ਕਰਨ ਵਾਲੇ ਲੋਕਾਂ ਲਈ ਬਹੁਤ ਸਾਰੇ ਮੌਕੇ ਹਨ ਇਹ ਮੌਕੇ ਨਾ ਸਿਰਫ ਸਵੈ ਰੁਜ਼ਗਾਰ ਲਈ ਸਹਾਇਕ ਹਨ ਸਗੋਂ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦੇ ਹਨ